ਸਾਡੇ ਖੇਤਰ ਵਿੱਚ ਲੋਕਾਂ ਨੂੰ ਸਭ ਤੋਂ ਜ਼ਿਆਦਾ ਆਮ ਸਿਹਤ ਸਮੱਸਿਆਵਾਂ ਇਹ ਹਨ ਕਿਉਂਕਿ ਅੱਜ ਕੱਲ੍ਹ ਦੇਖੋ ਪਾਣੀ ਥਾਂ ਥਾਂ 'ਤੇ ਪਾਣੀ ਖੜ੍ਹਾ ਰਹਿੰਦਾ ਉਹਦੇ ਨਾਲ ਮੱਛਰ ਪੈਦਾ ਹੁੰਦਾ ਮੱਛਰ ਘਰਾਂ 'ਚ ਜਾਂਦਾ ਲੋਕਾਂ ਦੇ ਡੇਂਗੂ ਮਲੇਰੀਆ ਦਾ ਲੋਕ ਸ਼ਿਕਾਰ ਹੁੰਦੇ ਨੇ ਟਾਈਫੈਡ ਵਗੈਰਾ ਇਹ ਆਮ ਬਿਮਾਰੀਆਂ ਸਾਡੇ ਖੇਤਰ ਵਿੱਚ ਇਹਨਾਂ ਦੀ ਜ਼ਿਆਦਾ ਪ੍ਰੋਬਲਮ ਹੈ ਟਾਈਫੈਡ ਟਾਈਫੈਡ ਡੇਂਗੂ ਮਲੇਰੀਆ ਅਤੇ ਲੋਕ ਬਹੁਤ ਜ਼ਿਆਦਾ ਬਿਮਾਰ ਰਹਿੰਦੇ ਨੇ ਪਾਣੀ ਕਰਕੇ ਮੱਛਰ ਥਾਂ ਥਾਂ 'ਤੇ ਹਰ ਇੱਕ ਜਗ੍ਹਾ ਮੱਛਰ ਹਰੇਕ ਦਿਨ ਘਰ ਮੱਛਰ ਹੁੰਦਾ ਬਸ ਸਾਡੇ ਆਹੀ ਨੋਰਮਲ ਤਾਂ ਜ਼ਿਆਦਾ ਆਹੀ ਬਿਮਾਰੀਆਂ ਨੇ ਅਤੇ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਵਿੱਚ ਸਿਵਲ ਹੋਸਪਿਟਲ ਹੈ ਉੱਥੇ ਬਿਮਾਰੀਆਂ ਦਾ ਇਲਾਜ ਹੁੰਦਾ ਅਤੇ ਲੋਕ ਠੀਕ ਹੋ ਜਾਂਦੇ